ਮੇਰੇ ਕੋਲ ਕਈ ਤਰ੍ਹਾਂ ਦੇ ਵਿਸ਼ੇਸ਼ ਹੁਨਰ ਹਨ ਮੈਂ ਲੱਕੜੀ ਦਾ ਕੰਮ ਬਹੁਤ ਹੀ ਵਧੀਆ ਕਰਦਾ ਹਾਂ ਮੈਂ ਲੱਕੜੀ ਦੇ ਟੇਬਲ ਅਤੇ ਕੁਰਸੀਆਂ ਬੈੱਡ ਅਲਮਾਰੀ ਫੱਟੇ ਆਦਿ ਬਹੁਤ ਵਧੀਆ ਤਿਆਰ ਕਰ ਲੈਂਦਾ ਹਾਂ ਮੈਨੂੰ ਬਿਜਲੀ ਦੇ ਕੰਮ ਬਾਰੇ ਵੀ ਬਹੁਤ ਹੀ ਜ਼ਿਆਦਾ ਨੌਲੇਜ ਹੈ ਮੈਂ ਪੱਖੇ ਆਪ ਲਾ ਲੈਂਦਾ ਹਾਂ ਸਾਰਾ ਕੰਮ ਬਿਜਲੀ ਦਾ ਮੈਂ ਕਰ ਲੈਂਦਾ ਹਾਂ ਟਰਾਂਸਫਾਰਮਾਂ ਕੰਮ ਵੀ ਮੈਂ ਕਰ ਕਰ ਲੈਂਦਾ ਹਾਂ ਮੈਂ ਪੱਖੇ ਲਾ ਲੈਂਦਾ ਹਾਂ ਏਸੀ ਕੂਲਰ ਆਦਿ ਜੋ ਵੀ ਕੰਮ ਹੈ ਮੈਂ ਘਰ ਦਾ ਸਾਰਾ ਕੰਮ ਬਿਜਲੀ ਦਾ ਆਪਣੇ ਆਪ ਹੀ ਕਰਦਾ ਹਾਂ ਅੱਜ ਤੱਕ ਕਿਸੇ ਇਲੈੱਕਟ੍ਰੀਸ਼ਨ ਨੂੰ ਨਹੀਂ ਬੁਲਾਇਆ ਮੈਨੂੰ ਮਸ਼ੀਨਰੀ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਮੈਂ ਮੋਟਰਸਾਈਕਲ ਵੀ ਆਪਣੇ ਆਪ ਠੀਕ ਕਰ ਲੈਂਦਾ ਹਾਂ ਮੇਰੇ ਮੋਟਰਸਾਈਕਲ ਦੇ ਵਿੱਚ ਕੋਈ ਵੀ ਖ਼ਰਾਬੀ ਹੁੰਦੀ ਹੈ ਮੈਂ ਝੱਟਪੱਟ ਉਹ ਖ਼ਰਾਬੀ ਠੀਕ ਕਰ ਦਿੰਦਾ ਹਾਂ ਮੈਨੂੰ ਟਰੈੱਕ ਟਰੈਕਟਰਾਂ ਦੀ ਵੀ ਬਹੁਤ ਜ਼ਿਆਦਾ ਨੌਲੇਜ ਹੈ ਮੈਂ ਕਈ ਆਪਣੇ ਪਿੰਡ ਕਈਆਂ ਦੇ ਟਰੈਕਟਰ ਠੀਕ ਕੀਤੇ ਹਨ ਉਹਨਾਂ ਦੀ ਮੁਰੰਮਤ ਕੀਤੀ ਹੈ ਜੇਕਰ ਕਿਸੇ ਦੇ ਟਰੈਕਟਰ ਨੂੰ ਕੁਝ ਹੋ ਜਾਂਦਾ ਹੈ ਤਾਂ ਉਹ ਮੈਨੂੰ ਬੁਲਾਉਂਦੇ ਹਨ ਮੈਂ ਜਾ ਕੇ ਉਹਨਾਂ ਦਾ ਟਰੈਕਟਰ ਠੀਕ ਕਰ ਦਿੰਦਾ ਹਾਂ ਅਤੇ ਉਹ ਲੋਕ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਹਨ ਮੈਂ ਮੋਟਰਸਾਈਕਲਾਂ ਦਾ ਕੰਮ ਵੀ ਬਹੁਤ ਹੀ ਜ਼ਿਆਦਾ ਵਧੀਆ ਕਰਦਾ ਹਾਂ ਮੈਨੂੰ ਸਾਰਾ ਕੰਮ ਆਉਂਦਾ ਹੈ ਟਰੈਕਟਰਾਂ ਦਾ ਮੋਟਰਸਾਈਕਲ ਦਾ ਲੱਕੜ ਦਾ ਆਦਿ